ਹੈਲੋ ਵੀਰ ਜੀ ਆਪਾਂ ਤਾਂ ਸੁਨਾਮ ਜਾਣਾ ਸੀ ਇਹ ਤੁਸੀਂ ਕਿਹੜੇ ਰਸਤੇ ਵਿੱਚੋਂ ਦੀ ਲੈ ਕੇ ਜਾ ਰਹੇ ਹੋ ਹਾਂਜੀ ਅੱਛਾ ਉਸ ਦ ਸੜਕ ਬਣ ਰਹੀ ਹੈ ਹੁਣ ਆਪਾਂ ਕਿਹੜੇ ਨਾਮੀ ਰਸਤੇ ਵਿੱਚੋਂ ਦੀ ਜਾਵਾਂਗੇ ਅੱਛਾ ਪਿੰਡਾਂ ਵਿੱਚੋਂ ਦੀ ਅੱਛਾ ਜੀ ਅਤੇ ਫਿਰ ਮੈਂ ਤਾਂ ਦੇਖੋ ਜਲਦੀ ਪਹੁੰਚਣਾ ਸੀਗਾ ਸੁਨਾਮ ਮੈਨੂੰ ਉੱਥੇ ਕੰਮ ਹੈ ਜ਼ਰੂਰੀ ਤੁਸੀਂ ਦੱਸੋ ਕਿੰਨਾ ਕੁ ਟੈ ਸਮਾਂ ਲੱਗ ਜਾਏਗਾ ਆਪਾਂ ਨੂੰ ਉੱਥੇ ਪਹੁੰਚਣ ਲਈ ਹਾਂਜੀ ਹਾਂਜੀ ਉੱਥੇ ਮੇਰਾ ਕੋਈ ਇੰਤਜ਼ਾਰ ਕਰ ਰਿਹਾ ਐਕਚੁਲੀ ਉਹਨਾਂ ਨੂੰ ਮੈਂ ਮਿਲਣ ਵਾਸਤੇ ਬੁਲਾਇਆ ਹੋਇਆ ਹੈਗਾ ਹਾਂਜੀ ਤਾਂ ਤੁਸੀਂ ਮੈਨੂੰ ਰਾਈਟ ਟਾਈਮ ਦੱਸ ਦਿਓ ਵੀ ਉੱਥੇ ਕਿੰਨੇ ਵਜੇ ਪਹੁੰਚਾਂਗੇ ਤਾਂ ਕਿ ਮੈਂ ਉਹਨਾਂ ਨੂੰ ਵੀ ਸਹੀ ਸਮਾਂ ਦੱਸ ਸਕਾਂ ਤਾਂ ਕਿ ਉਹ ਉੱਥੇ ਜਾ ਕੇ ਉਹਨਾਂ ਨੂੰ ਵੀ ਵੇਟ ਨਾ ਕਰਨਾ ਪਵੇ ਮੇਰਾ ਹਾਂਜੀ ਤੁਸੀਂ ਹਾਂਜੀ ਅੱਧਾ ਘੰਟਾ ਅੱਛਾ ਸਹੀ ਅੱਧਾ ਘੰਟਾ ਲੱਗੇਗਾ ਹਾਂਜੀ ਅੱਛਾ ਅ ਅੰਦਰ ਮੈਨੂੰ ਤਾਂ ਬਹੁਤ ਜਲਦੀ ਸੀਗਾ ਹਾਂਜੀ ਤੁਸੀਂ ਫਿਰ ਵੀ ਕੋਸ਼ਿਸ਼ ਕਰੋ ਕਿ ਆਪਾਂ ਜਲਦੀ ਤੋਂ ਜਲਦੀ ਪਹੁੰਚ ਪਾਈਏ ਉਥੇ ਹਾਂਜੀ ਨਹੀਂ ਰਾਈਟ ਟਾਈਮ ਪੱਕਾ ਉੱਥੇ ਆਪਾਂ ਅੱਧੇ ਘੰਟੇ ਬਾਅਦ ਪਹੁ ਅੱਛਾ ਜੋ ਆਪਣਾ ਟਾਈਮ ਹੈ ਉਸ ਤੋਂ ਅੱਧਾ ਘੰਟਾ ਬਾਅਦ ਠੀਕ ਹੈ ਠੀਕ ਹੈ ਮੈਂ ਫਿਰ ਉਹਨਾਂ ਨੂੰ ਫੋਨ ਕਰਕੇ ਦੱਸ ਦੇਵਾਂਗੀ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ